ਪੰਜਾਬੀ ਜੁੱਤੀ ਪੰਜਾਬ ਵਿੱਚ ਬਹੁਤ ਫੇਮਸ ਹੈ ਇ ਪੰਜਾਬੀ ਅ ਪੰਜਾਬੀ ਜੁੱਤੀ ਅ ਚਮੜੇ ਦੀ ਬਣਾਈ ਜਾਂਦੀ ਹੈ ਔਰ ਇਹ ਅ ਜੁੱਤੀ ਉੱਪਰ ਪੂਰਾ ਕਢਾਈ ਵਾਲਾ ਕਢਾਈ ਕੀਤੀ ਜਾਂਦੀ ਹੈ ਅਤੇ ਜੁੱਤੀਆਂ ਚਮੜੇ ਦੀਆਂ ਬਣਾ ਕੇ ਉਸ ਉੱਪਰ ਕੱਪੜਾ ਵੀ ਲਗਾ ਕੋਈ ਮਲਮਲ ਦਾ ਕੱਪੜਾ ਲਗਾ ਕੇ ਉਸ ਵਿੱਚ ਵਧੀਆ ਚਮੜਾ ਲਗਾ ਕੇ ਕਢਾਈ ਕੀਤੀ ਜਾਂਦੀ ਹੈ ਅਤੇ ਫਿਰ ਉਹ ਜੁੱਤੀਆਂ ਵੀ ਕਿੱਥੇ ਅ ਮਲੋਟ ਮੁਕਤਸਰ ਇਹ ਜੁੱਤੀਆਂ ਬਣਾਉਣ ਵਿੱਚ ਫੇਮਸ ਹੈ ਪੰ ਪੰਜਾਬੀ ਲੋਕ ਹਮੇਸ਼ਾ ਚਮੜੇ ਦੀ ਜੁੱਤੀ ਪਾਉਂਦੇ ਹੈ ਚਮੜੇ ਦੀ ਜੁੱਤੀ ਪਾ ਕੇ ਪੈਰ ਪੂਰਾ ਕੰਫਰਟੇਬਲ ਰਹਿੰਦਾ ਅਤੇ ਗਰਮੀ 'ਚ ਹਮੇਸ਼ਾ ਹੀ ਪੰਜਾਬੀ ਜੁੱਤੀ ਪਾਈ ਜਾਂਦੀ ਹੈ ਜੁੱਤੀਆਂ ਵਿਆਹ ਵਿਆਹ ਸ਼ਾਦੀਆਂ ਜੋ ਵੀ ਫੰਕਸ਼ਨ ਹੋਊ ਪੰਜਾਬੀ ਹਮੇਸ਼ਾ ਪੰਜਾਬੀ ਜੁੱਤੀ ਹੀ ਪਾਉਂਦੇ ਪਾਉਂਦੇ ਹਨ ਅਤੇ ਪੰਜਾਬੀ ਜੁੱਤੀ ਪਾਉਣ ਨਾਲ ਪੈਰ ਖ਼ਰਾਬ ਨਹੀਂ ਹੁੰਦੇ ਪੈਰਾਂ ਦਾ ਪਾਇਰ ਪੈਰ ਸਹੀ ਰਹਿੰਦੇ ਹਨ ਪੰਜਾਬੀ ਜੁੱਤੀ ਵਧੀਆ ਚਮੜੇ ਦੀ ਬਣੀ ਹੁੰਦੀ ਹੈ